ਪੰਜਾਬ ਦੇ ਇਤਿਹਾਸ ਬਾਰੇ ਜ਼ਿਆਦਾਤਰ ਪ੍ਰਾਚੀਨ ਸਾਹਿਤ ਹਨ ਭਾਵੇਂ ਇੱਥੇ ਢੁਕਵੇਂ ਇਤਿਹਾਸਿਕ ਸਾਹਿਤ ਦੀ ਘਾਟ ਹੈ ਪਰ ਸੰਸਕ੍ਰਿਤ ਸਾਹਿਤ ਦਾ ਵਿਸ਼ਾਲ ਭੰਡਾਰ ਜਿਵੇਂ ਵੇਦ ਉਪਨਿਸ਼ਦ ਪੁਰਾਣ ਅਤੇ ਦੋ ਮਹਾਨ ਮਹਾਂਕਾਵਿ ਪੰਜਾਬ ਦੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦਾ ਇੱਕ ਕੀਮਤੀ ਸਰੋਤ ਹਨ ਪੰਜਾਬ ਨੂੰ ਪ੍ਰਾਚੀਨ ਹਿੰਦੂ ਮਹਾਂਕਾਵਿਆਂ ਖਾਸ ਕਰਕੇ ਮਹਾਭਾਰਤ ਵਿੱਚ ਲਿਖਿਆ ਗਿਆ ਹੈ ਤਿੰਨ ਸੌ ਛੱਬੀ ਬੀ ਸੀ ਇਸ ਖੇਤਰ ਦੇ ਸਭ ਤੋਂ ਪਹਿਲਾਂ ਜਾਣੇ ਜਾਂਦੇ ਪ੍ਰਸਿੱਧ ਸਥਾਨਕ ਰਾਜੇ ਨੂੰ ਕਿੰਗ ਪੋਰਸ ਵਜੋਂ ਜਾਣਿਆ ਜਾਂਦਾ ਸੀ ਜਿਸ ਨੇ ਐਲਗਜੈਂਡਰ ਮਹਾਨ ਦੇ ਵਿਰੁੱਧ ਹਾਈਡਾਸਪੇਸ ਦੀ ਮਸ਼ਹੂਰ ਲੜਾਈ ਲੜੀ ਸੀ ਉਹ ਪੁਰਾਤਤਵ ਅਤੇ ਸਾਹਿਤਿਕ ਹਨ ਪੁਰਾਤਤਵ ਸਰੋਤ ਨੂੰ ਦੁਬਾਰਾ ਤਿੰਨ ਸਮੂਹਾਂ ਵਿੱਚ ਵੰਡਿਆ ਜਾ ਸਕਦਾ ਹੈ ਅਰਥਾਤ ਪੁਰਾਤਤਵ ਅਭਿਸ਼ੇਸ਼ ਅਤੇ ਸਮਾਰਕ ਸ਼ਿਲਾਲੇਖ ਅਤੇ ਸਿੱਕੇ ਸਾਹਿਤਿਕ ਸਰੋਤ ਨੂੰ ਵੀ ਤਿੰਨ ਸਮੂਹਾਂ ਵਿੱਚ ਵੰਡਿਆ ਜਾ ਸਕਦਾ ਹੈ ਅਰਥਾਤ ਧਾਰਮਿਕ ਸਾਹਿਤ ਧਰਮ ਨਿਰਪੱਖ ਸਾਹਿਤ ਅਤੇ ਵਿਦੇਸ਼ੀ ਲੋਕਾਂ ਦੇ ਲੇਖੇ ਜੋ ਮੰਨਦੇ ਹਨ ਕਿ ਉਪ ਮਹਾਂਦੀਪ ਵਿੱਚ ਪਹਿਲੀ ਮਨੁੱਖੀ ਸੱਭਿਅਤਾ ਵਿੱਚੋਂ ਇੱਕ ਪੱਚੀ ਸੌ ਈਸਾ ਪੂਰਵ ਦੇ ਆਸ ਪਾਸ ਪੰਜਾਬ ਵਿੱਚ ਸਥਾਪਿਤ ਹੋਈ ਸੀ ਅੰਮ੍ਰਿਤਸਰ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਆਪਣੇ ਅਮੀਰ ਸੱਭਿਆਚਾਰ ਲੋਕ ਨਾਚਾਂ ਮਸਾਲੇਦਾਰ ਪਕਵਾਨਾਂ ਖੇਤੀਬਾੜੀ ਤਿਉਹਾਰਾਂ ਸਿੱਖ ਗੁਰਦੁਆਰਿਆਂ ਆਦਿ ਲਈ ਮਸ਼ਹੂਰ ਰਿਹਾ ਹੈ ਪੰਜਾਬ ਦਾ ਅਰਥ ਹੈ ਪੰਜ ਪਾਣੀਆਂ ਦੀ ਧਰਤੀ ਪੰਜਾਬ ਦੇ ਇਤਿਹਾਸਿਕ ਸਥਾਨ ਇਸ ਧਰਤੀ ਦੇ ਅਮੀਰ ਅਤੇ ਰੰਗੀਨ ਇਤਿਹਾਸ ਨੂੰ ਦਰਸਾਉਂਦੇ ਹਨ ਭਾਰਤ ਦਾ ਸੱਭਿਆਚਾਰਕ ਇਤਿਹਾਸ ਜਲਿਆਵਾਲਾ ਬਾਗ ਅਤੇ ਵਾਹਗਾ ਬਾਰਡਰ ਵਰਗੀਆਂ ਥਾਵਾਂ ਮਹੱਤਵਪੂਰਨ ਹਨ ਹਰਿਮੰਦਰ ਸਾਹਿਬ ਅੰਮ੍ਰਿਤਸਰ ਪੰਜਾਬ ਵਿੱਚ ਹਰਿਮੰਦਰ ਸਾਹਿਬ ਵਜੋਂ ਵੀ ਜਾਣਿਆ ਜਾਂਦਾ ਹੈ ਵਿਸ਼ਵ ਭਰ ਵਿੱਚ ਸਿੱਖਾਂ ਲਈ ਸਭ ਤੋਂ ਸਤਿਕਾਰਿਕ ਤੀਰਥ ਸਥਾਨ ਹੈ ਚੌਥੇ ਸਿੱਖ ਗੁਰੂ ਗੁਰੂ ਰਾਮਦਾਸ ਜੀ ਦੁਆਰਾ ਪੰਦਰਾਂ ਸੌ ਸਤੱਤਰ ਵਿੱਚ ਸਥਾਪਿਤ ਸਥਾਪਿਤ ਕੀਤਾ ਗਿਆ ਇਸ ਦਾ ਪਾਵਨ ਅਸਥਾਨ ਸੋਨੇ ਨਾਲ ਸ਼ਿੰਗਾਰਿਆ ਗਿਆ ਹੈ ਜੋ ਇਸਦੇ ਨਾਮ ਅਤੇ ਸਿੱਖ ਆਰਕੀਟੈਕਚਰ ਦੀ ਸ਼ਾਨ ਨੂੰ ਦਰਸਾਉਂਦਾ ਹੈ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੌਰਾਨ ਜਲਿਆਵਾਲਾ ਬਾਗ ਪੰਜਾਬ ਵਿੱਚ ਇੱਕ ਮਹਾਨ ਇਤਿਹਾਸਿਕ ਸਥਾਨ ਸੀ ਇਹ ਅੰਮ੍ਰਿਤਸਰ ਦਾ ਇੱਕ ਜਨਤਕ ਬਗੀਚਾ ਹੈ ਜਿਸ ਵਿੱਚ ਰਾਸ਼ਟਰੀ ਮਹੱਤਵ ਦੀ ਇੱਕ ਯਾਦਗਾਰ ਹੈ ਜਿਸਦੀ ਸਥਾਪਨਾ ਉਨੀ ਸੌ ਇਕਵੰਜਾ ਵਿੱਚ ਭਾਰਤ ਸਰਕਾਰ ਦੁਆਰਾ ਤੇਰਾਂ ਅਪ੍ਰੈਲ ਉਨੀ ਸੌ ਉਨੀ ਨੂੰ ਬ੍ਰਿਟਿਸ਼ ਫੌਜਾਂ ਦੁਆਰਾ ਸ਼ਾਂਤਮਈ ਜਸ਼ਨ ਮਨਾਉਣ ਵਾਲਿਆਂ ਦੇ ਕਤਲੇਆਮ ਦੀ ਯਾਦ ਵਿੱਚ ਕੀਤੀ ਗਈ ਸੀ ਵਾਹਗਾ ਬਾਰਡਰ ਭਾਰਤ ਅਤੇ ਭਾਰਤ ਵਿਚਕਾਰ ਇੱਕ ਸੜਕੀ ਸਰਹੱਦ ਹੈ ਪਾਕਿਸਤਾਨ ਇਹ ਅੱਜ ਕੱਲ੍ਹ ਇੱਕ ਮਸ਼ਹੂਰ ਸੈਰ ਸਪਾਟਾ ਸਥਾਨ ਹੈ ਕਿਉਂਕਿ ਪ੍ਰਸਿੱਧ ਮੀਟਿੰਗ ਰਿਟਰੀਟ ਸਮਾਰੋਹ ਜੋ ਹਰ ਰੋਜ਼ ਸੂਰਜ ਡੁੱਬਣ ਤੋਂ ਪਹਿਲਾਂ ਆਯੋਜਿਤ ਕੀਤਾ ਜਾਂਦਾ ਹੈ ਇਸ ਸਮਾਰੋਹ ਦਾ ਹਿੱਸਾ ਬਣਨ ਲਈ ਲਗਭਗ ਪੰਜ ਹਜ਼ਾਰ ਲੋਕ ਸਰਹੱਦ 'ਤੇ ਆਉਂਦੇ ਹਨ ਝੰਡੇ ਦੀ ਰਸਮ ਭਾਰਤੀ ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨ ਰੇਂਜਰਾਂ ਦੁਆਰਾ ਸੰਚਾਲਿਤ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਸੋਲਵੀਂ ਸਦੀ ਵਿੱਚ ਰ ਗੁਰੂ ਰਾਮਦਾਸ ਜੀ ਦੁਆਰਾ ਬਣਾਇਆ ਗਿਆ ਇਹ ਕਈ ਲਗਾਤਾਰ ਗੁਰੂਆਂ ਦਾ ਘਰ ਰਿਹਾ ਹੈ ਸਮੇਂ ਦੇ ਨਾਲ ਗੁਰੂ ਅਰਜਨ ਦੇਵ ਜੀ ਦੁਆਰਾ ਵਾਧੂ ਚੇਂਬਰ ਜੋੜ ਦਿੱਤੇ ਗਏ ਸਨ ਅਤੇ ਕੰਪਲੈਕਸ ਹੁਣ ਸਿੱਖ ਇਤਿਹਾਸ ਦੇ ਇੱਕ ਪ੍ਰਭਾਵਸ਼ਾਲੀ ਪ੍ਰਤੀਬਿੰਬ ਵਜੋਂ ਖੜ੍ਹਾ ਹੈ